ਵੱਡੇ ਸਮਾਗਮਾਂ ਦੇ ਦੌਰਾਨ ਜਾਂ ਵਿਆਹਾਂ ਦੇ ਦੌਰਾਨ ਜਾਂ ਰੈਲੀਆਂ ਦੇ ਦੌਰਾਨ ਬੜੀ ਭਾਰੀ ਮਾਤਰਾ ਵਿੱਚ ਲੋਕਾਂ ਦੇ ਆਉਣ ਕਰਕੇ ਪਾਣੀ ਦਾ ਵੱਡਾ ਪ੍ਰਬੰਧ ਕੀਤਾ ਜਾਂਦਾ ਹੈ ਪਾਣੀ ਦਾ ਪ੍ਰਬੰਧ ਜਿਸ ਤਰ੍ਹਾਂ ਜੇ ਵਿਆਹ ਦੇ ਤਰੀਕੇ ਨਾਲ ਚਲੀਏ ਤਾਂ ਵਿਆਹ ਦੇ ਅਸੀਂ ਘਰ ਜਦੋਂ ਵਿਆਹ ਕਰਦੇ ਹਾਂ ਤਾਂ ਉਦੋਂ ਅਸੀਂ ਟਿਊਬਵੈਲ ਦਾ ਵਰਤੋਂ ਕਰਕੇ ਪਾਣੀ ਦੀ ਵਰਤੋਂ ਕਰਦੇ ਹਾਂ ਪਾਣੀ ਨੂੰ ਟੱਬਾਂ ਵਿੱਚ ਵੱਡੇ ਵੱਡੇ ਟੱਬਾਂ ਵਿੱਚ ਭਰ ਕੇ ਅਤੇ ਵਰਤਿਆ ਜਾਂਦਾ ਜਦੋਂ ਬਰਤਨਾਂ ਬਰਤਨ ਸਾਫ਼ ਕਰਨ ਵਾਸਤੇ ਵੀ ਅਸੀਂ ਪਾਣੀ ਦੀ ਵਰਤੋਂ ਕਰਦੇ ਹਾਂ ਹੋਰ ਜਿੱਦਾਂ ਆਪਾਂ ਸ਼ੁੱਧ ਪਾਣੀ ਪੀਣ ਵਾਸਤੇ ਅਸੀਂ ਬੋਤਲਾਂ ਦੀ ਵਰਤੋਂ ਕਰਦੇ ਹਾਂ ਜਾਂ ਗਲਾਸੀਆਂ ਦੀ ਵਰਤੋਂ ਕਰਦੇ ਹਾਂ ਜੇ ਅਸੀਂ ਪੈਲਸ ਵਿੱਚ ਜਾਈਏ ਤਾਂ ਉੱਥੇ ਸਾਨੂੰ ਪਾਣੀ ਦਾ ਪ੍ਰਬੰਧ ਬੋਤਲਾਂ ਜਾਂ ਇਹਦੇ ਵਿੱਚ ਹੀ ਕਰਨਾ ਪੈਂਦਾ ਹੈ ਬੁ ਤਾਂ ਜੋ ਕਿ ਸ਼ੁੱਧ ਪਾਣੀ ਹਰ ਇੱਕ ਨੂੰ ਪੀਣ ਵਾਸਤੇ ਮਿਲੇ ਜਿਸ ਕਰਕੇ ਕਿ ਵੱਡੀ ਮਾਤਰਾ ਵਿੱਚ ਪਾਣੀ ਨੂੰ ਅਸੀਂ ਗਲਾਸੀਆਂ ਜਾਂ ਬੋਤਲਾਂ ਰਾਹੀਂ ਵਰਤਦੇ ਹਾਂ